ਵੈਸੇ ਮੈਨੂੰ ਜ਼ਿਆਦਾਤਰ ਇਲੈਕਟ੍ਰੋਨਿਕ ਸੰਸਕਰਣ ਪਰ ਪੜ੍ਹਨੇ ਪਸੰਦ ਨਹੀਂ ਹਨ ਵੈਸੇ ਮੈਂ ਜ਼ਿਆਦਾਤਰ ਸਿੱਖ ਇਤਿਹਾਸ ਬਾਰੇ ਕਿਤਾਬਾਂ ਪੜ੍ਹਦਾ ਐਂ ਅਤੇ ਉਹਨਾਂ ਬਾਰੇ ਹੀ ਮੈਂ ਨਾ ਜ਼ਿਆਦਾ ਨੌਲੇਜ ਰੱਖਦਾ ਗੱਲ ਕੀਤੀ ਜਾਵੇ ਓਡੀਓ ਬੁੱਕ ਜ ਨੇ ਜਿਹੜੀਆਂ ਉਹਨਾਂ ਵਿੱਚ ਵੀ ਮੈਂ ਬਹੁਤ ਸਾਰੀਆਂ ਮਤਲਬ ਕਿ ਕਿਤਾਬਾਂ ਜਿਹੜੀਆਂ ਉਹ ਓਡੀਓ ਰਾਹੀਂ ਵੀ ਸੁਣੀਆਂ ਨੇ ਜਿੱਦਾਂ ਕਿ ਗੁਰੂ ਨਾਨਕ ਦੇਵ ਜੀ 'ਤੇ ਹੋਗੀਆਂ ਉੱਨੀ ਸੌ ਚੁਰਾਸੀ 'ਤੇ ਜਿਹੜੇ ਸਾਕੇ ਸੀਗੇ ਉਹਨਾਂ ਬਾਰੇ ਵੀ ਜਿੰਨੀਆਂ ਵੀ ਕਿਤਾਬਾਂ ਸੀਗੀਆਂ ਉਹ ਮੈਂ ਔਨਲਾਈਨ ਵੀ ਸੁਣੀਆਂ ਹੋਈਆਂ ਨੇ ਕਿਵੇਂ ਜਿਹੜੇ ਸੰਤ ਸੀਗੇ ਭਿੰਡਰਾਂਵਾਲੇ ਉਹਨਾਂ 'ਤੇ ਕਿਵੇਂ ਉਹਨਾਂ ਨੇ ਹਮਲਾ ਹੋਇਆ ਸੀਗਾ ਉਹ ਸਾਰੀਆਂ ਜੋ ਸਾਖੀਆਂ ਨੇ ਉਹ ਮੈਂ ਔਨਲਾਈਨ ਆਡੀਓ ਰਾਹੀ ਵੀ ਬਹੁਤ ਜ਼ਿਆਦਾ ਸੁਣੀਆਂ ਹੋਈਆਂ ਨੇ